ਭੰਗੜੇ ਦੀ ਮਹੱਤਤਾ ਇਹ ਹੈ ਕਿ ਭੰਗੜਾ ਸਿਰਫ ਪਹਿਲਾਂ ਪੰਜਾਬ ਵਿੱਚ ਸ਼ੁਰੂ ਹੋਇਆ ਸੀਗਾ ਪਰ ਹੁਣ ਅਲੱਗ ਅਲੱਗ ਜਗ੍ਹਾ 'ਤੇ ਹੀ ਪਾਇਆ ਜਾਂਦਾ ਹੈਗਾ ਭੰਗੜਾ ਪੰਜਾਬੀਆਂ ਦੀ ਪਹਿਚਾਣ ਹੈ ਜਿਸ ਤਰ੍ਹਾਂ ਵੀ ਸ਼ੁਰੂ ਮਤਲਬ ਇਸ ਦਾ ਜਨਮ ਪੰਜਾਬ ਵਿੱਚ ਹੀ ਹੋਇਆ ਸੀਗਾ ਭੰਗੜੇ ਦਾ ਅਤੇ ਭੰਗੜੇ ਵਾਲੇ ਭੰਗੜਾ ਗਰੁੱਪ ਦੇ ਵਿੱਚ ਵੀ ਪਾਇਆ ਜਾਂਦਾ ਜਿੱਦਾਂ ਪੰਜ ਛੇ ਜਾਣੇ ਰਲ ਕੇ ਭੰਗੜਾ ਪਾ ਸਕਦੇ ਨੇ ਭੰਗੜਾ ਇੱਕ ਜਣਾ ਵੀ ਪਾ ਸਕਦਾ ਭੰਗੜਾ ਇੱਕ ਪੰਜਾਬੀਆਂ ਦਾ ਇੱਕ ਕਲਚਰ ਹੈਗਾ ਭੰਗੜਾ ਪੰਜਾਬੀਆਂ ਦੀ ਜਾਨ ਹੈ ਭੰਗੜਾ ਭੰਗੜਾ ਹੋ ਗਿਆ ਗਿੱਧਾ ਹੋ ਗਿਆ ਇਹ ਪੰਜਾਬ ਵਿੱਚ ਹੀ ਪ੍ਰਚਲਿਤ ਸੀਗਾ ਬਟ ਹੁਣ ਅਲੱਗ ਅਲੱਗ ਜਗ੍ਹਾ 'ਤੇ ਫੋਰਨ ਕੰਟਰੀਆਂ ਦੇ ਵਿੱਚ ਵੀ ਜਿੱਦਾਂ ਕੋਈ ਫੰਕਸ਼ਨ ਵਗੈਰਾ ਕਰਾਏ ਜਾਂਦੇ ਨੇਗੇ ਉੱਥੇ ਵੀ ਭੰਗੜਾ ਵਗੈਰਾ ਪਾਇਆ ਜਾਂਦਾ ਹੈਗਾ ਜਾਂ ਸਕੂਲ ਹੋ ਗਏ ਆਪਣੇ ਕਾਲਜ ਹੋ ਗਏ ਕਾਲਜਾਂ ਦੇ ਵਿੱਚ ਅਲੱਗ ਅਲੱਗ ਪ੍ਰੋਗਰਾਮ ਪਰ ਕਰਵਾਏ ਜਾਂਦੇ ਨੇ ਪ ਕਲਚਰ ਪ੍ਰੋਗਰਾਮ ਹੋਵੇ ਕਲਚਰ ਪ੍ਰੋਗਰਾਮ ਵਿੱਚ ਭੰਗੜਾ ਹੋ ਗਿਆ ਭੰਗੜਾ ਪਵਾਇਆ ਜਾਂਦਾ ਗਾ ਅਤੇ ਭੰਗੜਾ ਇੱਕ ਬਹੁਤ ਜ਼ਿਆਦਾ ਮਤਲਬ ਕਿ ਪੰਜਾਬ ਦਾ ਬਹੁਤ ਜ਼ਿਆਦਾ ਮਸ਼ਹੂਰ ਹੈ ਭੰਗੜਾ ਅਲੱਗ ਅਲੱਗ ਤਰ੍ਹਾਂ ਜਿਵੇਂ ਜੁਗਨੀ ਹੋ ਗਿਆ ਅਲੱਗ ਅਲੱਗ ਸਟੈਪ ਨੇਗੇ ਇਹਦੇ ਅਲੱਗ ਅਲੱਗ ਤਰ੍ਹਾਂ ਪਾਇਆ ਜਾਂਦਾ ਹੈਗਾ ਭੰਗੜਾ ਅਤੇ ਹੁਣ ਇਹ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਰਹੇ ਅਤੇ ਪ ਇਹਨੂੰ ਭੰਗੜੇ ਨੂੰ ਹਰ ਇੱਕ ਲਾਈਕ ਕਰਦਾ ਗਾ ਅਤੇ ਅਲੱਗ ਅਲੱਗ ਜਗ੍ਹਾ 'ਤੇ ਹੀ ਮਤਲਬ ਕਿ ਜਦੋਂ ਕੋਈ ਪ੍ਰੋਗਰਾਮ ਹੁੰਦਾ ਤਾਂ ਭੰਗੜਾ ਪੈਂਦਾ ਹੀ ਪੈਂਦਾ ਗਾ